ਹਾਂਜੀ ਮੈਂ ਇੱਕ ਵਾਰੀ ਬਹੁਤ ਹੀ ਖਾਸ ਡਰਾਇੰਗ ਬਣਾਈ ਜਿਸ ਵਿੱਚ ਮੈਂ ਬਹੁਤ ਹੀ ਵਧੀਆ ਸਿਨਰੀ ਬਣਾਈ ਉਸ ਵਿੱਚ ਮੈਂ ਵੱਖ ਵੱਖ ਰੰਗਾਂ ਦੀ ਮਿਸ਼ਰਤ ਮੀਡੀਆ ਦੀ ਵਰਤੋਂ ਕਰਕੇ ਉਸਨੂੰ ਬਹੁਤ ਹੀ ਵਧੀਆ ਬਣਾਇਆ ਵੱਖ ਵੱਖ ਸਮੱਗਰੀਆਂ ਨੂੰ ਮਿਲਾ ਕੇ ਉਸ ਨੂੰ ਬਹੁਤ ਹੀ ਵਧੀਆ ਰੂਪ ਦਿੱਤਾ ਉਸ ਵਿੱਚ ਮੈਂ ਵੱਖ ਵੱਖ ਰੰਗ ਵਰਤੇ ਵੱਖ ਵੱਖ ਤਰ੍ਹਾਂ ਦੇ ਹੋਰ ਕਈ ਸਮਾਨ ਵਰਤੇ ਜਿਹੜੇ ਕਿ ਡਰਾਇੰਗ ਵਿੱਚ ਅਸੀਂ ਵਰਤ ਸਕਦੇ ਹਾਂ ਜਿਵੇਂ ਅਸੀਂ ਉਹਦੇ ਵਿੱਚ ਕਾਟਨ ਵਰਡਸ ਵਗੈਰਾ ਨਾਲ ਪੇਂਟਿੰਗ ਕੀਤੀ ਉਸ ਸਿਨਰੀ ਨੂੰ ਹੋਰ ਕਈ ਹੋਰ ਅਲੱਗ ਅਲੱਗ ਸਟੋਨਸ ਦੇ ਨਾਲ ਸਜਾਇਆ ਹੋਰ ਵੀ ਉਹਦੇ ਵਿੱਚ ਮੈਂ ਕਈ ਤਰ੍ਹਾਂ ਦੇ ਰੰਗ ਯੂਸ ਕੀਤੇ ਜਿਹਦੇ ਨਾਲ ਉਹ ਸੋਹਣੀ ਲੱਗੀ ਬਹੁਤ ਹੀ ਵਧੀਆ ਬਣੀ ਡਰਾਇੰਗ ਮੇਰੀ ਜਿਸ ਨਾਲ ਉਹਦੇ ਵਿੱਚ ਹੋਰ ਵੀ ਕਈ ਵੱਖ ਵੱਖ ਸਮਾਨ ਮਿਲਾ ਕੇ ਉਸ ਨੂੰ ਬਹੁਤ ਹੀ ਵਧੀਆ ਸ਼ਿੰਗਾਰਿਆ ਅਤੇ ਉਹ ਮੇਰੀ ਸਿਨਰੀ ਬਹੁਤ ਹੀ ਵਧੀਆ ਲੱਗ ਰਹੀ ਸੀ ਧੰਨਵਾਦ